ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਪਿੰਡ ਵਿੱਚ ਇਕ ਕਰਿਆਨੇ ਦੀ ਦੁਕਾਨ ਹੈ ਉਹ ਦੁਕਾਨ ਪਿੰਡ ਤੋਂ ਥੋੜ੍ਹੀ ਕੁ ਬਾਹਰ ਹੈ ਉਸ ਉਸ ਦੁਕਾਨ 'ਤੇ ਹਰ ਟਾਈਮ ਭੀੜ ਲੱਗੀ ਰਹਿੰਦੀ ਹੈ ਕਿਉਂਕਿ ਸਾਡੇ ਪਿੰਡ ਵਿੱਚ ਸਿਰਫ ਇੱਕ ਹੀ ਦੁਕਾਨ ਹੈ ਅਤੇ ਉਸ ਦੁਕਾਨ 'ਤੇ ਹੀ ਸਾਫ ਚੀਜ਼ਾਂ ਉਪਲਬਧ ਹੁੰਦੀਆਂ ਹਨ ਜਿਵੇਂ ਖਾਣ ਪੀਣ ਦਾ ਸਮਾਨ ਹੋ ਗਿਆ ਮੱਠੀਆਂ ਕੁਰਕਰੇ ਲੇਜ ਇਹ ਬੱਚਿਆਂ ਦੀਆਂ ਹਰਮਨ ਪਿਆਰਿਆਂ ਚੀਜ਼ਾਂ ਹਨ ਉਸੇ ਤਰ੍ਹਾਂ ਹੀ ਜਿਵੇਂ ਅਸੀਂ ਘਰ ਵਿੱਚ ਕੋਈ ਵੀ ਸਬਜ਼ੀ ਬਣਾਉਣੀ ਹੁੰਦੀ ਹੈ ਜਿਵੇਂ ਮਟਰ ਪਨੀਰ ਆਦਿ ਇੱਦਾਂ ਦੀਆਂ ਚੀਜ਼ਾਂ ਉੱਥੇ ਉਪਲਬਧ ਰਹਿੰਦੀਆਂ ਹਨ ਇਸ ਕਰਕੇ ਇਹ ਦੁਕਾਨ ਸਭ ਦੀ ਹਰਮਨ ਪਿਆਰੀ ਦੁਕਾਨ ਹੈ ਇਹ ਦੁਕਾਨ ਅਰਜੀਤ ਕਰਿਆਨਾ ਸਟੋਰ ਦੇ ਨਾਮ ਨਾਲ ਮੰਨੀ ਜਾਂਦੀ ਹੈ ਅਜੀਤ ਕਰਿਆਨਾ ਸਟੋਰ 'ਤੇ ਤਿੰਨ ਜਣੇ ਕੰਮ ਕਰਦੇ ਹਨ ਉਹ ਤਿੰਨੇ ਪਰਿਵਾਰ ਦੇ ਮੈਂਬਰ ਹੀ ਹਨ ਇਸ ਕਰਕੇ ਉਹ ਦੁਕਾਨ ਦਾ ਬਹੁਤ ਸਾਫ ਸਫਾਈ ਅਤੇ ਬਹੁਤ ਦੁਕਾਨ ਦਾ ਧਿਆਨ ਰੱਖਦੇ ਹਨ ਜਿਸ ਨਾਲ ਉਹਨਾਂ ਨੂੰ ਬਹੁਤ ਹੀ ਵਧੀਆ ਅਤੇ ਖੁਸ਼ੀ ਮਹਿਸੂਸ ਹੁੰਦੀ ਹੈ ਇਹ ਦੁਕਾਨ ਵਿੱਚ ਹਰ ਕਿਸੇ ਤਰ੍ਹਾਂ ਦੀ ਚੀਜ਼ ਮਿਲ ਜਾਂਦੀ ਹੈ ਅਸੀਂ ਇਸ ਵਿੱਚ ਬਹੁਤ ਸਾਰੀਆਂ ਸੁਵਿਧਾ ਵੀ ਪ੍ਰਾਪਤ ਕਰਦੇ ਹਾਂ ਜਿਵੇਂ ਕਿ ਸਾਡੇ ਕੋਲ ਉਸੇ ਟਾਈਮ ਹੀ ਪੈਸੇ ਦੇਣ ਨੂੰ ਨਹੀਂ ਹੁੰਦੇ ਅਤੇ ਅਸੀਂ ਉਹਨਾਂ ਤੋਂ ਉਧਾਰ ਸਮਾਨ ਵੀ ਲੈ ਆਉਂਦੇ ਹਾਂ ਅਤੇ ਬਾਅਦ ਵਿੱਚ ਉਹਨਾਂ ਨੂੰ ਪੈਸੇ ਦੇ ਦਿੰਦੇ ਹਾਂ ਉਹਨਾਂ ਕੋਲ ਸਾਰੀਆਂ ਸੁਵਿਧਾ ਉਪਲਬਧ ਹਨ ਜਿਵੇਂ ਗੂਗਲ ਪੇ ਫੋਨਪੇ ਆਦਿ ਜਦੋਂ ਵੀ ਚਾਹੀਏ ਅਸੀਂ ਉਹਨਾਂ ਨੂੰ ਪੈਸੇ ਦੇ ਆਉਂਦੇ ਹਾਂ ਅਤੇ ਉਹ ਘਰ ਵੀ ਸਮਾਨ ਪਹੁੰਚਾ ਦਿੰਦੇ ਹਨ ਇਸ ਕਰਕੇ ਸਾਨੂੰ ਇਹ ਦੁਕਾਨ ਬਹੁਤ ਹੀ ਵਧੀਆ ਲੱਗਦੀ ਹੈ ਅਤੇ ਅਸੀਂ ਆਪਦਾ ਜ਼ਿਆਦਾ ਟਾਈਮ ਵੀ ਉਹਨਾਂ ਕੋਲ ਹੀ ਬਿਤਾਉਂਦੇ ਹਾਂ ਕਿਉਂਕਿ ਅਸੀਂ ਉਹਨਾਂ ਦੇ ਦੋਸਤ ਹੋਣ ਕਾਰਨ ਉਹਨਾਂ ਦੇ ਨਾਲ ਕੰਮ ਕਾਰ ਵਿੱਚ ਥੋੜ੍ਹਾ ਹੱਥ ਵਟਾ ਦਿੰਦੇ ਹਾਂ ਧੰਨਵਾਦ